ਜਿੱਦਾਂ ਕਿ ਆਪਾਂ ਸਾਰੇ ਮੰਨਦੇ ਹਾਂ ਕਿ ਕਿਹੜੀ ਚਿੱਤਰਕਾਰੀ ਹੁੰਦੀ ਆ ਉਹ ਬਹੁਤ ਹੀ ਖ਼ਾਸ ਹੁੰਦੀ ਆ ਕੋਈ ਐਰਾ ਗੈਰਾ ਬੰਦਾ ਨਹੀਂ ਉਹਨੂੰ ਕਰ ਸਕਦਾ ਮੈਨੂੰ ਆਪ ਨੂੰ ਬਹੁਤ ਵਧੀਆ ਪੇਂਟਿੰਗ ਬਹੁਤ ਵਧੀਆ ਲੱਗਦੀ ਆ ਕਿਉਂਕਿ ਹੁਣ ਕਿੱਦਾਂ ਮੈਂ ਜੇ ਸਿੱਖਣਦਿਆ ਹਾਂ ਆਪਾਂ ਨੂੰ ਸਿੱਖਣ ਦੀਆਂ ਕਿਹੜੀਆਂ ਗਲਤੀਆਂ ਹੁੰਦੀਆਂ ਉਹਨਾਂ ਜੇ ਖਾਸ ਧਿਆਨ ਦੇਣਾ ਚਾਹੀਦਾ ਕਿਹੜੇ ਬਰੱਸ਼ ਹੁੰਦੇ ਆ ਉਹਨਾਂ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਕਲਰਸ ਹੁੰਦੇ ਆ ਉਹ ਕਿੱਦਾਂ ਵਰਤਣੇ ਆ ਆਪਾਂ ਬਰੱਸ਼ ਕਿੱਦਾਂ ਵਰਤਣਾ ਬਰੱਸ਼ ਫੜਨਾ ਕਿੱਦਾਂ ਆਪਾਂ ਸਭ ਤੋਂ ਪਹਿਲੀ ਗੱਲ ਕਿ ਜਿਹੜੀ ਆਪਾਂ ਚਿੱਤਰਕਾਰੀ ਬਣਾਉਣੀ ਆ ਉਹ ਤੋਂ ਪਹਿਲਾਂ ਇੱਕ ਹਾਸ਼ੀਆ ਤਿਆਰ ਕਰੀਦਾ ਵਾ ਆਪਾਂ ਨੂੰ ਕਿਹੜੀ ਚਿੱਤਰਕਾਰੀ ਉਹ ਬਹੁਤ ਹੀ ਮਤਲਬ ਕਿ ਆਪਾਂ ਨੂੰ ਐਨ ਰਿਲੈਕਸ ਹੋ ਕੇ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੀ ਚਿੱਤਰਕਾਰੀ ਉਹ ਕਿਸੇ ਦੇ ਦਬਾਵ 'ਚ ਆ ਕੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਆਪਣੀ ਕਿਹੜੀ ਚਿੱਤਰਕਾਰੀ ਆ ਉਹ ਆਪਾਂ ਨੂੰ ਵੱਧ ਤੋਂ ਵੱਧ ਵਧੀਆ ਕਿੰਨਾ ਆਪਾਂ ਆਰਾਮ ਨਾਲ ਚਿੱਤਰਕਾਰੀ ਕਰਾਂਗੇ ਉਹ ਉੱਨੀ ਸੋਹਣੀ ਹੋਊਗੀ ਆਪਾਂ ਨਹੀਂ ਇੱਕ ਚਿੱਤਰਕਾਰੀ ਦੀਆਂ ਵੀ ਬਹੁਤ ਕਿਸਮਾਂ ਹੁੰਦੀਆਂ ਕਿੱਦਾਂ ਪੋਟਰੇਟ ਹੋ ਗਈ ਜਾਂ ਥਰੀ ਡੀ ਹੋ ਗਈ ਜਾਂ ਆਪਣਾ ਮੰਨ ਲਉ ਕਿ ਸਿੰਪਲ ਹੋ ਗਈ ਪੈਂਨਸਿਲ ਆਰਟ ਹੋ ਗਈ ਸਕੈੱਚ ਆਰਟ ਹੋ ਗਈ ਜਾਂ ਹੋਰ ਕੋਈ ਵੀ ਬਹੁਤ ਸਾਰੀਆਂ ਚਿੱਤਰਕਾਰੀਆਂ ਹੁੰਦੀਆਂ ਵਾ ਆਪਾਂ ਜ਼ਿਆਦਾਤਰ ਲੋਕ ਅੱਜ ਕੱਲ੍ਹ ਡੀ ਅਤੇ ਪੋਟਰੇਟ ਹੁੰਦੀ ਆ ਆਪਾਂ ਮੰਨ ਲਉ ਕਿ ਟੈਟੂ ਬਣਵਾਉਂਦੇ ਹਾਂ ਉਹਦੇ ਲਈ ਵੀ ਡਰਾਇੰਗ ਚਾਹੀਦੀ ਆ ਮਤਲਬ ਇੱਕ ਵਾਰੀ ਜਿੱਦਾਂ ਆਪਾਂ ਕੋਈ ਵੀ ਹੁੰਦਾ ਵਾ ਕਿ ਕਿਹੜੇ ਹੁੰਦੇ ਆ ਬਿਲਡਿੰਗਸ ਜਡੈਇੰਨ ਕਰਦੇ ਹਾਂ ਆਪਣਾ ਕੱਪੜੇ ਜਡੈਨ ਕਰਦੇ ਹਾਂ ਜਾਂ ਹੋਰ ਵੀ ਉਹਦੇ ਮਤਲਬ ਹਰ ਪਾਸੇ ਹਰ ਇੱਕ ਖੇਤਰ ਵਿੱਚ ਚਿੱਤਰਕਾਰੀ ਦਾ ਕਿਸੇ ਨਾ ਕਿਸੇ ਵੱਲੋ ਹਿੱਸਾ ਹੈਗਾ ਵਾ